ਪੰਜਾਬ ਵਿੱਚ ਕਾਨੂੰਨੀ ਸੇਵਾਵਾਂ ਬਾਰੇ ਅੱਜ ਕੱਲ੍ਹ ਕਾਫ਼ੀ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਇਹ ਕਾਨੂੰਨੀ ਸੇਵਾਵਾਂ ਬਹੁਤ ਹੀ ਆਸਾਨ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਨਾਗਰਿਕ ਜ਼ਿਆਦਾ ਔਖੇ ਨਾ ਹੋਣ ਇਹ ਜਾਗਰੂਕਤਾ ਵਿੱਚ ਨਾਗਰਿਕਾਂ ਨੂੰ ਸਭ ਕੁਛ ਦੱਸਿਆ ਜਾਂਦਾ ਹੈ ਅਤੇ ਕਿਸੇ ਵੀ ਨਾਗਰਿਕ ਵਾਸਤੇ ਬਹੁਤ ਆਸਾਨ ਹੈ ਕਿ ਉਹ ਕਿਸੇ ਵੀ ਕੋਰਟ ਵਿੱਚ ਜਾ ਕੇ ਕਿਸੇ ਵੀ ਆਪਣੇ ਕੰਮ ਸੰਬੰਧੀ ਕੇਸ ਪਾ ਸਕਦਾ ਹੈ ਅਤੇ ਜੇਕਰ ਉਸਨੂੰ ਕਿਸੇ ਵੀ ਕੇਸ ਵਿੱਚ ਕਿਸੇ ਵਕੀਲ ਦੀ ਲੋੜ ਹੈ ਤਾਂ ਉਹ ਇੱਕ ਸਰਕਾਰੀ ਵਕੀਲ ਦੀ ਵੀ ਸਹਾਇਤਾ ਲੈ ਸਕਦਾ ਹੈ ਜੋ ਵੀ ਕੋਈ ਇਨਸਾਨ ਇੱਕ ਪ੍ਰਾਈਵੇਟ ਵਕੀਲ ਨੂੰ ਨਹੀਂ ਅਫੋਰਡ ਕਰ ਸਕਦਾ ਉਸ ਨੂੰ ਸਰਕਾਰ ਹਮੇਸ਼ਾਂ ਸਹਾਇਤਾ ਕਰਦੀ ਹੈ ਆਪਣੇ ਵੱਲੋਂ ਇੱਕ ਸਰਕਾਰੀ ਵਕੀਲ ਦੇ ਕੇ ਸਰਕਾਰ ਨੇ ਕਾਫ਼ੀ ਵੈਬਸਾਈਟਾਂ ਵੀ ਇੰਟਰਨੈੱਟ ਉੱਤੇ ਚਾਲੂ ਕੀਤੀਆਂ ਹਨ ਜਿਸ ਦੇ ਉੱਤੇ ਜਾ ਕੇ ਅਸੀਂ ਕਿਸੇ ਵੀ ਕਾਨੂੰਨ ਬਾਰੇ ਪੜ੍ਹ ਸਕਦੇ ਹਾਂ ਅਤੇ ਜੇਕਰ ਤੁਹਾਡੇ ਨਾਲ਼ ਕੁਛ ਵੀ ਗਲਤ ਹੋ ਰਿਹਾ ਹੈ ਤਾਂ ਉੱਥੇ ਇਸ ਬਾਰੇ ਕੰਪਲੇਂਟ ਫਾਈਲ ਕਰ ਸਕਦੇ ਹਾਂ ਕੁਝ ਲੋਕ ਅਦਾਲਤਾਂ ਵੀ ਕਾਫ਼ੀ ਅੱਜ ਕੱਲ੍ਹ ਖੁੱਲ੍ਹ ਗਈਆਂ ਹਨ ਜਿੱਥੇ ਕੋਈ ਵੀ ਇਨਸਾਨ ਸਿੱਧਾ ਜਾ ਕੇ ਆਪਣਾ ਕੇਸ ਰੱਖ ਸਕਦਾ ਹੈ ਅਤੇ ਉਸਨੂੰ ਕੋਈ ਵੀ ਜ਼ਿਆਦਾ ਪਹਿਲਾਂ ਕੰਮ ਕਰਨ ਦੀ ਲੋੜ ਨਹੀਂ ਹੈ ਕੋਈ ਕਾਗਜ਼ਾਦ ਜ਼ਿਆਦਾ ਭਰਨ ਦੀ ਲੋੜ ਨਹੀਂ ਹੈ